ਮੈਂ ਲਿਖਣ ਵੇਲੇ ਪ੍ਰੇਰਿਤ ਅਤੇ ਫੋਕਸ ਰਹਿਣ ਲਈ ਬਹੁਤ ਕੁਝ ਕਰਦੀ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਸ਼ਾਂਤ ਜਿਹੀ ਜਗ੍ਹਾ ਚੁਣਦੀ ਹਾਂ ਤਾਂ ਕਿ ਮੈਨੂੰ ਕੋਈ ਵੀ ਪਰੇਸ਼ਾਨ ਨਾ ਕਰ ਸਕੇ ਅਤੇ ਉਸ ਤੋਂ ਬਾਅਦ ਮੈਂ ਇਹ ਤੈਅ ਕਰਦੀ ਹਾਂ ਕਿ ਮੈਂ ਜੋ ਵੀ ਲਿਖਣ ਜਾ ਰਹੀ ਹਾਂ ਉਹ ਕਿੰਨੇ ਸਮੇਂ ਤੱਕ ਲਿਖਣਾ ਹੈ ਇਸ ਤੋਂ ਬਾਅਦ ਮੈਂ ਜੋ ਵੀ ਲਿਖਣਾ ਹੈ ਉਹ ਮੈਂ ਬੜੇ ਹੀ ਧਿਆਨ ਪੂਰਵਕ ਲਿਖਣਾ ਸ਼ੁਰੂ ਕਰ ਦਿੰਦੀ ਹਾਂ ਮੈਂ ਰੋਜ਼ ਡਾਇਰੀਆਂ ਵੀ ਲਿਖਦੀ ਹਾਂ ਅਤੇ ਡਾਇਰੀ ਉੱਤੇ ਮੈਂ ਆਪਣੇ ਜੋ ਵੀ ਖਿਆਲ ਅਤੇ ਵਿਚਾਰ ਹੁੰਦੇ ਨੇ ਉਹਨਾਂ ਨੂੰ ਮੈਂ ਲਿਖਦੀ ਹਾਂ ਮੈਂ ਜ਼ਿਆਦਾਤਰ ਜੋ ਘਟਨਾ ਹੁਣੇ ਹੁਣੇ ਵਾਪਰੀ ਹੁੰਦੀ ਆ ਉਹਦੇ ਬਾਰੇ ਵੀ ਲਿਖਦੀ ਹਾਂ ਮੈਨੂੰ ਪੰਜਾਬੀ ਭਾਸ਼ਾ ਦੇ ਵਿੱਚ ਲਿਖਣਾ ਬਹੁਤ ਪਸੰਦ ਹੈ ਇਸ ਕਰਕੇ ਮੈਂ ਪੰਜਾਬੀ ਵਿੱਚ ਹੀ ਆਪਣੀ ਡਾਇਰੀ ਲਿਖਦੀ ਹਾਂ